ਅੱਜ ਦੇ ਸਮੇਂ ਵਿੱਚ ਪ੍ਰਦੂਸ਼ਣ ਬਹੁਤ ਹੈ ਜਿਹਦੇ ਕਰਕੇ ਸਾਨੂੰ ਆਸਮਾਨ ਵਿੱਚ ਰਾਤ ਦੇ ਸਮੇਂ ਤਾਰੇ ਸਪਸ਼ਟ ਨਹੀਂ ਦਿਖਦੇ ਇਸਦਾ ਮੇਨ ਕਾਰਨ ਇਹ ਹੈ ਕਿ ਆਵਾਜਾਈ ਦੇ ਸਾਧਨ ਆਵਾਜਾਈ ਦੇ ਸਾਧਨ ਜ਼ਿਆਦਾ ਹੋਣ ਕਰਕੇ ਪ੍ਰਦੂਸ਼ਣ ਜ਼ਿਆਦਾ ਫੈਲਦਾ ਹੈ ਗੱਡੀਆਂ ਕਰਕੇ ਪ੍ਰਦੂਸ਼ਣ ਜ਼ਿਆਦਾ ਫੈਲਦਾ ਹੈ ਅਤੇ ਇਹਦੇ ਕਰਕੇ ਆਸਮਾਨ ਵਿੱਚ ਤਾਰੇ ਨਹੀਂ ਮਿਲ ਰਹੇ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਜੋ ਲੋਕ ਪਰਾਲੀ ਨੂੰ ਅੱਗ ਜ਼ਿਆਦਾ ਲਾਉਂਦੇ ਨੇ ਅੱਗ ਜ਼ਿਆਦਾ ਲਾਉਣ ਨਾਲ ਧੂਆਂ ਫੈਲਦਾ ਹੈ ਜਿਹਦੇ ਕਰਕੇ ਪ੍ਰਦੂਸ਼ਣ ਪ੍ਰਦੂਸ਼ਣ ਕਾਰਨ ਵੀ ਸਾਨੂੰ ਕੁਛ ਨ ਵੀ ਚੰਗੀ ਤਰ੍ਹਾਂ ਨਹੀਂ ਦਿਖਾਈ ਦਿੰਦਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਸਰਕਾਰ ਨੂੰ ਇਹਨਾਂ ਚੀਜ਼ਾਂ ਉੱਤੇ ਰੋਕ ਲਾਉਣੀ ਚਾਹੀਦੀ ਹੈ ਜਿਹੜੇ ਸਾਧਨ ਜ਼ਿਆਦਾ ਪ੍ਰਦੂਸ਼ਣ ਫੈਲ ਫੈਲਾਉਂਦੇ ਨੇ ਉਹਨਾਂ 'ਤੇ ਹੀ ਉਹਨਾਂ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਦੀਵਾਲੀ ਦੀਵਾਲੀ 'ਤੇ ਵੀ ਪਟਾਕਿਆ ਜ਼ਿਆਦਾ ਪਟਾਕੇ ਚਲਾਉਣ 'ਤੇ ਪਾਬੰਦੀ ਹੋਣੀ ਚਾਹੀਦੀ ਹੈ ਜੋ ਕਿ ਸਰਕਾਰ ਇਹਨਾਂ ਵੱਲ ਧਿਆਨ ਦੇਵੇ ਤਾਂ ਪ੍ਰਦੂਸ਼ਣ ਘੱਟ ਸਕੇ ਜਿਹਦੇ ਨਾਲ ਸਾਨੂੰ ਪ੍ਰਦੂਸ਼ਣ ਕਰਕੇ ਹੀ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਹਦੇ ਨਾਲ ਸਾਨੂੰ ਸਾਹ ਲੈਣ ਵਿੱਚ ਵੀ ਕਾਫੀ ਦਿੱਕਤ ਆਉਂਦੀ ਹੈ ਇਸ ਲਈ ਸਾਨੂੰ ਪ੍ਰਦੂਸ਼ਣ 'ਤੇ ਜ਼ਿਆਦਾ ਤੋਂ ਜ਼ਿਆਦਾ ਸਰਕਾਰ ਨੂੰ ਅਤੇ ਸਾਨੂੰ ਆਪ ਨੂੰ ਕੰਟਰੋਲ ਕਰਨਾ ਚਾਹੀਦਾ ਹੈ